ਚਾਰ ਅਪ੍ਰੈਲ ਉੱਨੀ ਸੌ ਬਹੱਤਰ ਦਸ ਅਕਤੂਬਰ ਉੱਨੀ ਸੌ ਉਨਾਸੀ ਛੱਬੀ ਅਕਤੂਬਰ ਦੋ ਹਜ਼ਾਰ ਇੱਕ ਨੌ ਅਗਸਤ ਦੋ ਹਜ਼ਾਰ ਚਾਰ ਸਤਾਈ ਸਤੰਬਰ ਉੱਨੀ ਸੌ ਅਠਾਨਵੇਂ